ਸਤਿ ਸ਼੍ਰੀ ਅਕਾਲ ਜੀ ਮੈਂ ਗੁਰਮੀਤ ਸਿੰਘ ਬੋਲ ਰਿਹਾ ਹਾਂ ਮੈਂ ਆਪਣੇ ਕਿਸੇ ਜ਼ਰੂਰੀ ਮੀਟਿੰਗ ਲਈ ਚੰਡੀਗੜ੍ਹ ਵਿਖੇ ਜਾਣਾ ਸੀ ਮੈਨੇ ਮੈਂ ਮੁਹਾਲੀ ਤੋਂ ਆਪਣੇ ਜਿਹੜੀ ਹੈਗੀ ਹੈ ਕੈਬ ਬੁੱਕ ਕਰਵਾਈ ਸੀ ਜਿਸਦਾ ਕਿ ਟਾਈਮ ਅਪ੍ਰੋਕਸੀਮੇਟਲੀ ਤਿੰਨ ਵੱਜ ਕੇ ਤੀਹ ਮਿੰਟ ਸੀ ਪ੍ਰੰਤੂ ਚਾਰ ਵੱਜ ਕੇ ਦਸ ਕੁ ਮਿੰਟ ਹੋ ਗਏ ਹਨ ਹਾਲੇ ਤੱਕ ਤੁਹਾਡੀ ਕੈਬ ਦੀ ਜਿਹੜੀ ਹੈਗੀ ਹੈ ਮੇਰੇ ਕੋਲ਼ ਨਹੀਂ ਪਹੁੰਚੀ ਅਤੇ ਤੁਹਾਡਾ ਡਰਾਈਵਰ ਵੀ ਮੈਨੂੰ ਕੋਈ ਆਪਣਾ ਫ਼ੋਨ ਨਹੀਂ ਚੁੱਕ ਰਿਹਾ ਇਸ ਕਰਕੇ ਮੈਂ ਆਪਣੀ ਜਿਹੜੀ ਹੈਗੀ ਹੈ ਕੈਬ ਜਿਹੜੀ ਹੈਗੀ ਹੈ ਉਹ ਕੈਂਸਲ ਕਰਵਾਉਣਾ ਚਾਹੁੰਦਾ ਹਾਂ ਇਸ ਕਰਕੇ ਮੇਰੀ ਜਿਹੜੀ ਹੈਗੀ ਹੈ ਉਹ ਕੈਬ ਜਿਹੜੀ ਹੈਗੀ ਆ ਉਹ ਕੈਂਸਲ ਕੀਤੀ ਜਾਵੇ ਅਤੇ ਮੇਰੀ ਬਣਦੀ ਰਕਮ ਜਿਹੜੀ ਹੈਗੀ ਹੈ ਉਹ ਮੇਰੇ ਖਾਤੇ ਦੇ ਵਿੱਚ ਪਾ ਦਿੱਤੀ ਜਾਵੇ ਥੈਂਕ ਯੂ